ਹੈਲੋ ਹਾਂਜੀ ਹਾਂਜੀ ਹਾਂਜੀ ਬਿਲਕੁਲ ਹਾਂਜੀ ਦਸ ਕਿਹੜੀ ਕਿਹੜੇ ਮੰਥ ਦੀ ਦਸ ਦਸੰਬਰ ਠੀਕ ਆ ਜੀ ਹਾਂਜੀ ਅੱਛਾ ਜੀ ਠੀਕ ਆ ਜੀ ਬਿਲਕੁਲ ਜੀ ਹਾਂਜੀ ਹੈਗਾ ਸਰ ਪਹਿਲਾਂ ਇਹ ਦੱਸੋ ਵੀ ਤੁਸੀਂ ਪਲੇਟ ਸਿਸਟਮ ਕਰਨਾ ਕਿ ਵੈਸੇ ਤੁਸੀਂ ਆਪਣਾ ਸਮਾਨ ਲਿਆ ਕੇ ਦੋਓਂਗੇ ਅਸੀਂ ਰੈਡੀ ਕਰਨਾ ਸਰ ਜੇ ਪਰ ਹੈਡ ਕਰਦੇ ਓਂ ਤਾਂ ਉਹਦੇ ਵਿੱਚ ਤੁਸੀਂ ਕੀ ਕੀ ਵਰਾਈਟੀਜ਼ ਲਿਖਾਉਣਾ ਚਾਹੁੰਦੇ ਹੋ ਵੀ ਕੁਝ ਆਈਡੀਆ ਦੱਸੋਂ ਉਹਦੇ ਅਕੋਡਿੰਗ ਹੀ ਪਲੇਟ ਹੋ ਗਈ ਨਾ ਠੀਕ ਹੈ ਜੀ ਜੂਸ ਕੋਲਡ ਡਰਿੰਕ ਹੋ ਗਿਆ ਹਾਂਜੀ ਸ਼ੇਕ ਵਗੈਰਾ ਐਡ ਕਰ ਲੈਨੇ ਆ ਹਾਂਜੀ ਹਾਂਜੀ ਨਹੀਂ ਪਹਿਲਾਂ ਸਨੈਕਸ ਦੱਸੋ ਨਾ ਵੀ ਸਨੈਕਸ ਕੀ ਕੀ ਲੈਣਾ ਜਿਵੇਂ ਕਿ ਮਨਚੂਰੀਅਨ ਹੋ ਗਏ ਕੱਟਲੈਟ ਹੋ ਗਏ ਮੋਮੋਸ ਹੋ ਗਏ ਸਪਰਿੰਗ ਰੋਲਸ ਹੋ ਗਏ ਵੀ ਇਵੇਂ ਕੀ ਲੈਣਾ ਚਾਹੁੰਦੇ ਹੋ ਨਾਲ ਇਹ ਵੀ ਦੱਸੋ ਨਾ ਕੁਝ ਸਨੈਕਸ ਵਿੱਚ ਕੀ ਕੁਝ ਲੈਣਾ ਠੀਕ ਹੈ ਜੀ ਅੱਛਾ ਅਤੇ ਇੱਕ ਜਿਹੜੀਆਂ ਸਟੋਲਸ ਹੁੰਦੀਆਂ ਉਹਨਾਂ ਵਿੱਚ ਜਿਵੇਂ ਟਿੱਕੀ ਹੋ ਗਈ ਡੋਸਾ ਹੋ ਗਿਆ ਨਿਊਡਲਸ ਹੋ ਗਏ ਅਤੇ ਦੋ ਉਹਨਾਂ ਵਿੱਚੋਂ ਦੇਖੋ ਡੋਸੇ ਦੇ ਚਾਰਜਿਸ ਜ਼ਿਆਦਾ ਹੁੰਦੇ ਨੇ ਉਹ ਤੁਸੀਂ ਦੱਸੋ ਵੀ ਡੋਸਾ ਕਰਨਾ ਤੁਸੀਂ ਐਡ ਕਿ ਨਹੀਂ ਵੀ ਗੋਲਗੱਪੇ ਕਰਨੇ ਆ ਉਹ ਥੋੜ੍ਹੇ ਸਸਤੇ ਪੈ ਜਾਂਦੇ ਆ ਨਿਊਡਲਸ ਸਸਤੇ ਪੈ ਜਾਂਦੇ ਆ ਡੋਸਾ ਥੋੜ੍ਹਾ ਹੋਸਟਲੀ ਹੋ ਜਾਂਦਾ ਠੀਕ ਆ ਜੀ ਹਾਂਜੀ ਅਤੇ ਨਹੀਂ ਜੀ ਉਹ ਤਾਂ ਪੂਰਾ ਆਪਣਾ ਸਿਰ ਵੀ ਢੱਕ ਕੇ ਰੱਖਣਗੇ ਗਲੱਵਸ ਵੀ ਪਾਉਣਗੇ ਡਰੈਸ ਵੀ ਯੂਨੀਫੋਮ ਵੀ ਪ੍ਰੋਪਰ ਹੋਵੇਗੀ ਔਰ ਉਹਨਾਂ ਦੀ ਸਰਵਿਸ ਵਿੱਚ ਵੀ ਕੋਈ ਕਮੀ ਨਹੀਂ ਹੋਵੇਗੀ ਸਰ ਦੇਖੋ ਜੇ ਤਾਂ ਪਲੇਟ ਸਿਸਟਮ ਤੁਸੀਂ ਇਹਨਾਂ ਦੇ ਅਕੋਡਿੰਗ ਕਰਵਾਉਨੇ ਓਂ ਔਰ ਤੁਸੀਂ ਲੰਚ ਵਿੱਚ ਨਹੀਂ ਦੱਸਿਆ ਵੀ ਕੀ ਕੀ ਆ ਵੀ ਜਿਵੇਂ ਲੰਚ ਵਿੱਚ ਤੁਸੀਂ ਕਿੰਨੀਆਂ ਵੈਜੀਟੇਬਲ ਕਰਨੇ ਕਰਡ ਕਿਹੜਾ ਕਰਵਾਉਂਨੇ ਹੋ ਸੈਲਡ ਕਿਹੜਾ ਕਰਵਾਉਂਨੇ ਹੋ ਉਹ ਸਾਰਾ ਥੋੜ੍ਹਾ ਡਿਟੇਲ 'ਚ ਦੱਸ ਦਿੰਦੇ ਉਹਦੇ ਅਕੋਡਿੰਗ ਅਸੀਂ ਤੁਹਾਨੂੰ ਦਸ ਦਿੰਦੇ ਹਾਂਜੀ

ਹਾਂਜੀ ਸਰ ਦੇਖੋ ਤੁਸੀਂ ਜੋ ਵੀ ਆਹ ਸਾਰਾ ਕੁਝ ਸਾਨੂੰ ਦੱਸਿਆ ਇਹਦੇ ਅਕੋਡਿੰਗ ਸਾਡੀ ਪੰਦਰ੍ਹਾਂ ਸੌ ਰੁਪਏ ਪਰ ਮੈਂਬਰ ਪਲੇਟ ਆ ਮੋਰਨਿੰਗ ਵਾਲੀ ਪਲੇ ਪਲੇਟ ਕਾਊਂਟ ਕੀਤੀ ਜਾਵੇਗੀ ਠੀਕ ਹੈ ਜੀ ਅਤੇ ਕੋਲਡ ਡ੍ਰਿੰਕ ਹੋ ਗਈ ਜੂਸ ਹੋ ਗਿਆ ਉਹ ਸਾਰਾ ਦਿਨ ਸ਼ਾਮ ਤੱਕ ਚੱਲੂਗਾ ਲਗਾਤਾਰ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਕੋਈ ਨਹੀਂ ਜੀ ਤੁਸੀਂ ਆਜੋ ਇੱਕ ਵਾਰ ਵਿਜਿਟ ਕਰੋ ਠੀਕ ਆ ਜੀ ਠੀਕ ਹੈ ਸਰ ਓਕੇ